ਮੈਂ ਕਿਤਾਬ ਨੂੰ ਪੂਰਾ ਕਰਨ ਲਈ ਆਮ ਤੌਰ 'ਤੇ ਕਿਤਾਬ 'ਤੇ ਨਿਰਭਰ ਕਰਦਾ ਕਿਤਾਬ ਕਿੰਨੇ ਪੇਜਾਂ ਦੀ ਹੈ ਤਾਂ ਵੀਹ ਪੇਜਾਂ ਦੀ ਹੈ ਪੰਜਾਹ ਪੇਜਾਂ ਦੀ ਹੈ ਸੌ ਪੇਜਾਂ ਦੀ ਹੈ ਉਹ 'ਤੇ ਨਿਰਭਰ ਕਰਦਾ ਵੀ ਤੁਸੀਂ ਇੰਨਾ ਸਮਾਂ ਲੈਨੇ ਓ ਬਾਕੀ ਲਗਾਤਾਰ ਪੜ੍ਹਨ ਦੀ ਗੱਲ ਤਿੰਨ ਘੰਟੇ ਵੀ ਪੜ੍ਹ ਸਕਦੇ ਹਾਂ ਦੋ ਘੰਟੇ ਵੀ ਪੜ੍ਹ ਸਕਦੇ ਹਾਂ ਜਾਣੀ ਦੋ ਤੋਂ ਤਿੰਨ ਘੰਟੇ ਲਗਾਤਾਰ ਪੜ੍ਹ ਸਕਦੇ ਹਾਂ ਅਤੇ ਹਫਤਾਵਾਰੀ ਟੀਚੇ ਆਪਣੇ ਕੋਲ ਕੋਈ ਜਦੋਂ ਟਾਈਮ ਮਿਲਦਾ ਉਦੋਂ ਸਮਾਂ ਮਿਲੇ ਆਪਾਂ ਪੜ੍ਹ ਲਈਦਾ ਸਵੇਰੇ ਵੀ ਡਿਊਟੀ ਆਉਣ ਤੋਂ ਪਹਿਲਾਂ ਵੀ ਥੋੜ੍ਹਾ ਬਹੁਤਾ ਪੜ੍ਹ ਲਈਦਾ ਅਤੇ ਬਾਕੀ ਲੰਚ ਕਰਨ ਤੋਂ ਬਾਅਦ ਜੇ ਟਾਈਮ ਮਿਲਦਾ ਤਾਂ ਪੜ੍ਹ ਲਈਦਾ ਰਾਤ ਨੂੰ ਵੀ ਰੋਟੀ ਪਾਣੀ ਖਾਣ ਤੋਂ ਬਾਅਦ ਪੈਣ ਲੱਗੇ ਵੀ ਥੋੜ੍ਹਾ ਬਹੁਤਾ ਪੜ੍ਹ ਲਈਦਾ ਜਾਣੀ ਪੜ੍ਹਾਈ ਨਾਲ ਵਧੀਆ ਨੌਲੇਜ ਗਿਆਨ ਮਿਲਦਾ ਰਹਿੰਦਾ